ਪੁਰਾਣੇ ਸਮੇਂ ਤੋਂ ਚੱਲੀਆਂ ਆ ਰਹੀਆਂ ਤਿੰਨ ਫ਼ਸਲਾਂ ਮੱਕੀ ਝੋਨਾ ਕਣਕ ਝੋਨੇ ਨੂੰ ਦੇਖੀਏ ਝੋਨੇ ਦੇ ਕਾਰਨ ਪਾਣੀ ਜਿਹੜਾ ਹੈ ਪੰਜਾਬ ਦਾ ਉਹ ਬਹੁਤ ਡੂੰਘਾ ਹੋ ਗਿਆ ਹੈ ਪਾਣੀ ਡੂੰਘਾ ਹੋਣ ਦੇ ਕਾਰਨ ਜਿਹੜਾ ਕਿ ਹੈ ਬਹੁਤ ਆਉਣ ਵਾਲੇ ਸਮੇਂ ਵਿੱਚ ਬਹੁਤ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਪਾਣੀ ਵੀ ਖਤਮ ਕਰਕੇ ਦੇ ਦਿਆਂਗੇ ਨਹੀਂ ਤਾਂ ਦਰਿਆ ਦਾ ਇੱਕ ਸੌਰਸ ਹੈ ਸਾਡੇ ਕੋਲ ਸਤਲੁਜ ਦਰਿਆ ਦਾ ਇਹਦਾ ਪਾਣੀ ਵੀ ਦੂਸਰੀਆਂ ਸਟੇਟਾਂ ਨੂੰ ਚਲਾ ਜਾਂਦਾ ਹੈ ਅਤੇ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ ਹੈ ਅਗਰ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਹੀਏ ਕਿ ਤੁਸੀ ਝੋਨੇ ਨੂੰ ਛੱਡ ਕੇ ਸਬਜ਼ੀਆਂ ਲਗਾਓ ਫਰੂਟ ਲਗਾਓ ਦਾਲਾਂ ਦੀ ਖੇਤੀ ਕਰੋ ਤਾਂ ਜੋ ਕਿ ਪਾਣੀ ਨੂੰ ਅਸੀਂ ਬਚਾ ਸਕੀਏ ਜਿਸ ਕਾਰਨ ਆਉਣ ਵਾਲੀ ਪੀੜ੍ਹੀ ਪਾਣੀ ਦਾ ਸਹੀ ਇਸਤੇਮਾਲ ਕਰ ਸਕੇਗੀ